ਜੀ ਹਾਂ ਮੈਂ ਲੋਕਾਂ ਨੂੰ ਦੇਖਣ ਲਈ ਆਪਣੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਸਨ ਅੱਜ ਕੱਲ੍ਹ ਮੋਬਾਈਲ ਆਉਣ ਕਰਕੇ ਬਹੁਤ ਸਾਰੀਆਂ ਐਪਲੀਕੇਸ਼ਨਾਂ ਦਾ ਵੀ ਇਸ਼ਕ ਆਵਿਸ਼ਕਾਰ ਹੋ ਚੁੱਕਿਆ ਹੈ ਜਿਵੇਂ ਕੀ ਵਟਸਐਪ ਇੰਸਟਾਗ੍ਰਾਮ ਫੇਸਬੁਕ ਇਹਨਾਂ ਉੱਤੇ ਲੋਕ ਆਪਣੇ ਫੋਟੋਆਂ ਪਾਉਂਦੇ ਹਨ ਜਿਹਨਾਂ ਨੂੰ ਸਟੇਟਸ ਕਿਹਾ ਜਾਂਦਾ ਹੈ ਅਤੇ ਇਸ ਸਟੇਟਸ ਨੂੰ ਸਾਰੇ ਲੋਕੀ ਆਪਣੇ ਹੀ ਸਮੇ ਅਨੁਸਾਰ ਵੇਖ ਲੈਂਦੇ ਹਨ ਅਤੇ ਇੱਕ ਦੂਜੇ ਨੂੰ ਰਿਪਲਾਈ ਕਰਦੇ ਹਨ ਕਿ ਉਹਨਾਂ ਨੂੰ ਕਿਵੇਂ ਦਾ ਲੱਗਿਆ ਇਸ ਕਰਕੇ ਮੈਂ ਵੀ ਜਦੋਂ ਆਪਣੇ ਕਿਤੇ ਵਿਆਹ ਜਾਂ ਜਨਮਦਿਨ ਆਪਣੇ ਕਿਵੇਂ ਦੋਸਤਾਂ ਨਾਲ ਪਾਰਟੀਆਂ ਕਰਨ ਦੇ ਟਾਈਮ 'ਤੇ ਮੈਂ ਆਪਣੀਆਂ ਬਹੁਤ ਸਾਰੀਆਂ ਫੋਟੋਆਂ ਖਿੱਚ ਲੈਂਦਾ ਹਾਂ ਜੋ ਕਿ ਮੈਂ ਆਪਣੇ ਵਿਹਲੇ ਟਾਈਮ ਵਿੱਚ ਵਟਸਐਪ 'ਤੇ ਸਟੇਟਸ ਲਗਾਉਂਦਾ ਹਾਂ ਤਾਂ ਮੈਨੂੰ ਕਈ ਸਾਰੇ ਲੋਕਾਂ ਦੇ ਮੈਸੇਜ ਆਉਂਦੇ ਹਨ ਜਿਵੇਂ ਕਿ ਅੱਛਾ ਲੱਗ ਰਿਹਾ ਹੈ ਵੋ ਕਿੱਥੇ ਗਿਆ ਸੀ ਅਤੇ ਇਹਨਾਂ ਮੈਂ ਸਿੱਧਾ ਨਾਲ ਰਿਪਲਾਈ ਕਰਕੇ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ ਅਤੇ ਇਹ ਤਜਰਬਾ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ ਮੈਂ ਦੋ ਤਿੰਨ ਸਾਲ ਤੋਂ ਇਹ ਚੀਜ਼ ਕਰ ਰਿਹਾ ਹਾਂ ਅੱਜ ਕੱਲ੍ਹ ਕਾਫੀ ਟਾਈਮ ਤੋਂ ਪਹਿਲਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਸਨ ਉਸ ਤੋਂ ਪਹਿਲਾਂ ਅਸੀਂ ਇੱਕ ਦੂਜੇ ਨੂੰ ਆਪਣੀਆਂ ਅਣ ਆਉ ਆਪਣੀਆਂ ਆਪਣੀਆਂ ਮਨ ਦੀਆਂ ਭਾਵਨਾ ਚਿੱਠੀਆਂ ਰਾਹੀਂ ਭੇਜਦੇ ਸਨ ਬਟ ਅੱਜ ਕੱਲ੍ਹ ਲੋਕ ਹੁਣ ਸਟੇਟਸਾਂ 'ਤੇ ਹੀ ਆਪਣੀ ਫੋਟੋ ਨਾਲ ਅਤੇ ਇਹ ਕੈਪਸ਼ਨ ਲਿਖ ਕੇ ਆਪਣੀਆਂ ਭਾਵਨਾ ਪ੍ਰਸਤੁਤ ਕਰ ਦਿੰਦੇ ਹਨ ਇਹ ਚੀਜ਼ਾਂ ਮੈਂ ਵੀ ਕਦੇ ਕਦੇ ਕਰ ਲੈਂਦਾ ਹਾਂ ਅਤੇ ਇਹੀ ਤਜਰਬਾ ਮੈਨੂੰ ਬਹੁਤ ਹੀ ਵੱਧਦਾ ਜਾ ਰਿਹਾ ਹੈ ਇਸ ਕਰਕੇ ਲੋਕਾਂ ਦਾ ਪ੍ਰਦਰਸ਼ਿਤ ਕੀਤੀਆਂ ਸਨ ਅਤੇ ਮੈਂ ਬਹੁਤ ਹੀ ਖੁਸ਼ ਹੁੰਦਾ ਹਾਂ ਇਹ ਚੀਜ਼ਾਂ ਵੇਖ ਕੇ ਧੰਨਵਾਦ